ਹੈ ਹੈਲੋ ਕਿੱਥੋਂ ਬੋਲਦੇ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਗੁਆਂਢ ਦੇ ਵਿੱਚ ਚੋਰੀ ਹੋ ਗਈ ਹੈ ਜੀ ਇਸ ਕਰਕੇ ਤੁਹਾਨੂੰ ਫੋਨ ਕਰਿਆ ਵੀ ਚੋਰਾਂ ਬਾਰੇ ਜਾਣਕਾਰੀ ਲੈਣ ਵਾਸਤੇ ਚੋਰਾਂ ਦੀ ਪਹਿਚਾਣ ਕਰਨ ਵਾਸਤੇ ਸਾਡੇ ਗੁਆਂਢ ਦੇ ਵਿੱਚ ਜੋ ਰਹਿ ਰਹੇ ਸੀ ਉਹ ਕਿਸੇ ਬਾਹਰ ਜ਼ਰੂਰੀ ਕੰਮ ਗਏ ਹੋਏ ਸੀ ਲੈਟਾਂ ਬੰਦ ਕਰਕੇ ਗਏ ਸੀ ਪਰ ਜਦੋਂ ਸਾਨੂੰ ਖੜਕਾ ਦੜਕਾ ਜਿਹਾ ਸੁਣਿਆ ਅਸੀਂ ਘਰ ਆਪਣੇ ਆਰਾਮ ਨਾਲ ਸੁੱਤੇ ਪਏ ਸੀ ਖੜਕਾ ਦੜਕਾ ਸੁਣ ਕੇ ਅਸੀਂ ਉੱਠੇ ਤਾਂ ਦੇਖਿਆ ਲੈਟਾਂ ਚੱਲ ਰਹੀਆਂ ਨੇ ਉਹਨਾਂ ਦਾ ਸਮਾਨ ਖਿਲਰਿਆ ਪਿਆ ਉਹਨਾਂ ਦਾ ਦਰਵਾਜ਼ਾ ਖੁੱਲ੍ਹਾ ਪਿਆ ਸਾਨੂੰ ਫੇਸ ਬੇਸ ਤੋਂ ਪਤਾ ਲੱਗਿਆ ਵੀ ਜੇ ਤਾਂ ਚੋਰੀ ਹੋਈ ਆ ਚੋਰ ਚੋਰੀ ਕਰਕੇ ਲੈ ਗਏ ਨੇ

ਅਸੀਂ ਵਾਰਡ ਨੰਬਰ ਪੰਜ ਨੇੜੇ ਹਸਪਤਾਲ ਇਹ ਰਾਤ ਦੇ ਬਾਰਾਂ ਇੱਕ ਵਜੇ ਦੀ ਗੱਲ ਹੈ ਬਾਹਰ ਕੋਈ ਗੱਡੀ ਜਾਂ ਕੋਈ ਹੋਰ ਆਉਂਦਾ ਜਾਂਦਾ ਨਹੀਂ ਦੇਖਿਆ ਨਹੀਂ ਘਰ ਕੋਈ ਨਹੀਂ ਸੀ ਲਾਈਟਾਂ ਬੰਦ ਕਰਕੇ ਗਏ ਸੀ ਕੋਈ ਨਹੀਂ ਸੀ ਘਰ ਪਿੱਛੋਂ ਚੋਰ ਆਏ ਨੇ ਹਾਂ ਇੱਥੇ ਲਿਖੋ ਜੀ ਨੇਕ ਸਿੰਘ ਗੁਆਂਡ ਦਾ ਕੰਮ ਹੈ ਸਾਡੇ ਨੇਕ ਸਿੰਘ ਉਹਨਾਂ ਦਾ ਨਾਂ ਹੈ ਵਾਰਡ ਨੰਬਰ ਪੰਜ ਨੇੜੇ ਹਸਪਤਾਲ ਸਰ ਹਾਂ ਚੋਰਾਂ ਦਾ ਜੀ ਪਤਾ ਕਰੋ ਸਾਡੇ ਜਵਾਕ ਡਰਦੇ ਆ ਅਸੀਂ ਸਹਿਮ ਗਏ ਸਾਰੇ ਕਿ ਦਿਨ ਇਸ ਤਰ੍ਹਾਂ ਕਿਸ ਤਰ੍ਹਾਂ ਚੋਰੀ ਹੋ ਗਈ ਆਪਣਾ ਕੀ ਬਣੂਗਾ ਇਸ ਕਰਕੇ ਤੁਹਾਡੀ ਮਦਦ ਦੀ ਲੋੜ ਹੈ ਜੀ ਹਾਂ ਹਾਂ ਜੀ ਹਾਂ ਸਾਨੂੰ ਮਾੜਾ ਜਿਹਾ ਫੋਨ ਕਰਕੇ ਆਇਓ ਅਸੀਂ ਘਰ ਰਹਾਂਗੇ ਅਤੇ ਤੁਹਾਡਾ ਪੂਰਾ ਇੰਤਜ਼ਾਰ ਕਰਾਂਗੇ ਤੁਹਾਡੀ ਹਰ ਮਦਦ ਵੀ ਕਰਾਂਗੇ ਜੀ ਅੱਛਾ ਚੰਗਾ ਜੀ ਸਤਿ ਸ਼੍ਰੀ ਅਕਾਲ